ਹੈਲੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਤੁਸੀਂ ਸਵਿੱਗੀ ਤੋਂ ਬੋਲਦੇ ਹੋ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਓਡਰ ਦੇਣਾ ਚਾਹੁੰਦੀ ਹਾਂ ਇਸ ਓਡਰ ਵਿੱਚ ਮੈਂ ਤੁਹਾਨੂੰ ਇਸ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਪੰਜਾਹ ਬ ਲੋਕਾਂ ਲਈ ਬਰਗਰ ਪੀਜੇ ਅਤੇ ਪਾਸਤਾ ਚਾਹੀਦਾ ਹੈ ਮੈਂ ਸੁ ਸੁਣਿਆ ਸੀ ਕਿ ਤੁਸੀਂ ਆਪਣੇ ਓਡਰ ਵਿੱਚ ਮੈਨੂੰ ਛੂਟ ਦਿਉਂਗੇ ਇਸ ਓਡਰ ਵਿੱਚ ਮੈਨੂੰ ਛੂਟ ਮਿਲੇਗੀ ਇਸ ਕਰਕੇ ਮੈਂ ਤੁਹਨੂੰ ਪੰਜਾਹ ਲੋਕਾਂ ਲਈ ਇਹ ਓਡਰ ਦੇਣਾ ਚਾਹੁੰਦੀ ਹਾਂ ਇਹ ਓਡਰ ਦਾ ਪਤਾ ਮੈਂ ਤੁਹਾਨੂੰ ਦੇ ਦੇਵਾਂਗੀ ਇਸ ਲਈ ਤੁਸੀਂ ਸਮਾਨ ਮੈਨੂੰ ਆ ਮੇਰੇ ਪਤੇ 'ਤੇ ਭੇਜ ਦੇਣਾ ਹਾਂਜੀ ਤੁਸੀਂ ਮੈਨੂੰ ਛੂਟ ਦਿਓ ਇਸ ਕਰਕੇ ਮੈਂ ਤੁਹਾਡੇ ਤੋਂ ਇਹ ਸਮਾਨ ਮੰਗਵਾਉਣਾ ਚਾਹੁੰਦੀ ਹਾਂ ਮੈਂ ਆਪਣੀ ਮੇਰੀ ਫਰੈਂਡ ਨੇ ਦੱਸਿਆ ਸੀ ਕਿ ਤੁਸੀਂ ਆਪਣੇ ਇਸ ਹੋਟਲ 'ਚ ਵਧੀਆ ਛੂਟ ਦਿੰਦੇ ਹੋ ਇਸ ਕਰਕੇ ਮੈਂ ਤੁਹਾਨੂੰ ਇਹ ਓਡਰ ਦੇਣਾ ਚਾਹੁੰਦੀ ਹਾਂ ਇਸ ਲਈ ਤੁਹਾਡੇ ਕੋਲ ਕੋਈ ਕਾਰਡ ਹੋਵੇਗਾ ਕੁਪਣ ਹੋਵੇਗਾ ਉਸ ਕੁਪਣ 'ਤੇ ਕੋਈ ਮੈਨੂੰ ਵਧੀਆ ਤੁਸੀਂ ਛੂਟ ਦਿਓ ਇਸ ਮੈਂ ਆਪਣੀ ਫਰੈਂਡ ਤੋਂ ਪੁੱਛਿਆ ਸੀ ਉਹ ਕਹਿੰਦੀ ਸੀ ਉਨ੍ਹਾਂ ਦਾ ਸਮਾਨ ਬਹੁਤ ਵਧੀਆ ਹੁੰਦਾ ਹੈ ਉਹ ਉਹ ਸਮਾਨ ਓਇਲੀ ਬਿਲਕੁਲ ਨਹੀਂ ਬਣਾ ਬਣਾਉਂਦੇ ਇਸ ਕਰਕੇ ਪਲੀਸ ਤੁਸੀਂ ਮੈਨੂੰ ਛੂਟ ਦਿਓ ਥੈਂਕ ਯੂ